ਹੈਲੋ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹੋਰ ਘਰ ਕਿਵੇਂ ਘਰ ਪਰਿਵਾਰ ਕਿਵੇਂ ਆ ਠੀਕ ਆ ਹਾਂਜੀ ਹਾਂਜੀ ਹਾਂਜੀ ਹੋਰ ਘਰ ਪਰਿਵਾਰ ਕਿਵੇਂ ਆ ਠੀਕ ਆ ਚਲੋ ਵਧ ਵਧੀਆ ਵਧੀਆ ਵਧੀਆ ਆਪਣੀ ਸੁਣਾਓ ਬੱਚੇ ਠੀਕ ਆ ਨਿੱਕੂ ਠੀਕ ਆ ਅੱਛਾ ਅੱਛਾ ਅੱਛਾ ਹੋਰ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਵੀ ਉਹ ਆਪਣੇ ਨਾ ਸੜਕ ਟੁੱਟੀ ਪਈ ਆ ਆਪਣੇ ਬੂਹਿਆਂ ਦੇ ਅੱਗੇ ਉਹ ਹਾਂ ਮੈਂ ਇਹ ਕਹਿੰਦੀ ਹਾਂ ਵੀ ਕਈ ਵਾਰੀ ਬਜ਼ੁਰਗ ਬਹਿੰਦੇ ਆ ਆਪਾਂ ਵੀ ਬਹਿੰਦੇ ਆ ਬੱਚੇ ਵੀ ਲੰਘਦੇ ਆ ਹੈ ਨਾ ਹਾਂਜੀ ਵੀਹਕਲ ਲੰਘਦੇ ਆ ਮੈਂ ਇਹ ਕਹਿੰਦੀ ਹਾਂ ਵੀ ਜੇ ਆਪਾਂ ਉਹਦੀ ਥੋੜ੍ਹੀ ਜਿਹੀ ਰਿਪੇਅਰ ਕਰਵਾ ਦਈਏ ਇੱਕੋ ਜਿਹਾ ਥਾਂ ਬਣਵਾ ਲਈਏ ਹਾਂਜੀ ਮੈਂ ਇਹ ਕਹਿੰਦੀ ਹਾਂਜੀ ਹਾਂਜੀ ਮੈਂ ਇਹ ਕਹਿੰਦੀ ਹਾਂ ਵੀ ਜੇ ਆਪਾਂ ਅੱਗੇ ਲੱਗੀਏ ਅੱਗੇ ਲੱਗ ਕੇ ਆਪਾਂ ਕਰਵਾਈਏ ਉਹ ਹਾਂਜੀ ਹਾਂਜੀ ਅੱਗੇ ਲੱਗਾਂਗੇ ਆਪਾਂ ਅੱਗੇ ਲੱਗਾਂਗੇ ਆਪਾਂ ਹਾਂਜੀ ਹਾਂਜੀ ਵੀ ਆਪਾਂ ਅੱਗੇ ਲੱਗੀਏ ਅੱਗੇ ਲੱਗੀਏ ਵੀਹਕਲ ਲੰਘਦੇ ਆ ਗੱਡੀਆਂ ਲੰਘਦੀਆਂ ਮੋਟਰਸਾਈਕਲ ਲੰਗਦੇ ਕਈ ਵਾਰੀ ਬੱਚੇ ਸਕੂਲ ਵਾਲੇ ਵੀ ਲੰਘਦੇ ਉਹਨਾਂ ਨੂੰ ਵੀ ਔਖਾ ਹੋ ਜਾਂਦਾ ਹਾਂਜੀ ਕਈ ਵਾਰੀ ਬੰਦਾ ਵੀਹਕਲ ਲੈ ਕੇ ਬਜ਼ੁਰਗ ਹੀ ਲੰਘ ਸਕਦੇ ਆ ਬਜ਼ੁਰਗਾਂ ਦਾ ਵੀ ਔ ਹਾਂਜੀ ਹਾਂਜੀ ਵੀ ਬਜ਼ੁਰਗ ਲੰਘਦੇ ਆ ਕਈ ਵਾਰੀ ਬਜ਼ੁਰਗ ਹੁੰਦੇ ਆ ਨਹੀਂ ਪਤਾ ਲੱਗਦਾ ਹਨੇਰੇ ਸਵੇਰੇ ਜਾਂਦੇ ਨੁਕਸਾਨ ਹੋ ਸਕਦਾ ਹੈ ਨਾ ਹਾਂਜੀ ਹਾਂ ਹਾਂਜੀ ਹਾਂਜੀ ਹੋਰ ਤੁਹਾਡੀ ਦੁਕਾਨ ਕਿੱਦਾਂ ਚੱਲਦੀ ਆ ਠੀਕ ਚਲਦੀ ਆ ਹਾਂਜੀ ਹਾਂਜੀ ਹੋਰ ਹਾਂਜੀ ਹਾਂਜੀ ਚਲੋ ਪਰਮਾ ਹਾਂਜੀ ਪਰਮਾਤਮਾ ਤੰਦਰੁਸਤੀ ਦੇਵੇ ਹੈ ਨਾ ਪੈਸਾ ਤਾਂ ਆਈ ਜਾਂਦਾ ਜਾਈ ਜਾਂਦਾ ਹੱਥਾਂ ਦੀ ਮੈਲ ਪੈਸਾ ਤਾਂ

ਹਾਂਜੀ ਹਾਂਜੀ ਹਾਂਜੀ ਹਾਂਜੀ ਇਹ ਤਾਂ ਹੈਗਾ ਨਾ ਹੋਰ ਮੈਂ ਨਾ ਕੱਲ੍ਹ ਸੋਚੀ ਜਾਂਦੀ ਸੀ ਮੈਂ ਖਾਂ ਵੀ ਇਹਨਾਂ ਨਾਲ ਗੱਲ ਕਰੀਏ ਗੱਲ ਕਰਕੇ ਵੀ ਆਪਾਂ ਉਹਨੂੰ ਰਿਪੀਆਰ ਕਰਵਾਈਏ ਸੋਹਣਾ ਬਣਵਾਈਏ ਅੱਗੋਂ ਮਿੱਟੀ ਮਾਟੀ ਪਵਾ ਕੇ ਅਤੇ ਜਾ ਹਾਂਜੀ ਹਾਂਜੀ ਹਾਂਜੀ ਹਾਂਜੀ ਬਾਕੀ ਐਂ ਆ ਵੀ ਜੇ ਵਾਤਾਵਰਨ ਸਹੀ ਹੋਵੇਗੀ ਆਪਣੀ ਤਾਂ ਆਪਾਂ ਬੈਠੇ ਵੀ ਸੋਹਣੇ ਲੱਗਾਂਗੇ ਵਾਤਾਵਰਨ ਵਧੀਆ ਹੋਵੇਗੀ ਹਰਿਆਲੀ ਹੋਵੇ ਹੈ ਨਾ ਇਹਦਾ ਕਰਕੇ ਕਹਿੰਦੇ ਆ ਵੀ ਵਾਤਾਵਰਨ ਸਹੀ ਹੋਵੇਗੀ ਆਪਣੇ ਬੱਚੇ ਬੈਠਣਗੇ ਆਪਾਂ ਬੈਠਾਂਗੇ ਕੋਈ ਬਿਮਾਰੀ ਨਹੀਂ ਲੱਗਦੀ ਮੱਛਰ ਨਹੀਂ ਪੈਦਾ ਹੁੰਦਾ ਹੈ ਨਾ ਹਾਂਜੀ ਹਾਂਜੀ ਹਾਂਜੀ ਹਾਂਜੀ ਹੁਣ ਗੌਰਮੈਂਟਾਂ ਵੇਖੋ ਕਿੰਨੀਆਂ ਸੜਕਾਂ ਖਰਾਬ ਆ ਅਤੇ ਗੌਰਮੈਂਟ ਆਪਣੀ ਮਾਰੀ ਸਹਾਇਤਾ ਦਿੰਦੀ ਆ ਆਪਾਂ ਨੂੰ ਵੀ ਕੋਈ ਡਿੱਗ ਨਾ ਪਵੇ ਹਾਂ ਹਾਂਜੀ ਹਾਂਜੀ ਹਾਂਜੀ ਨਹੀਂ ਆਪਾਂ ਕਰਦੇ ਹਾਂ ਰਲ ਮਿਲ ਕੇ ਕਰਦੇ ਹਾਂ ਆਪਾਂ ਚਾਰ ਪੈਸੇ ਲਾਉਣੇ ਹਾਂ ਆਪਾਂ ਇੱਥੇ ਵਧੀਆ ਪਾਰਕਿੰਗ ਬਣਾਈਏ ਵਧੀਆ ਆਪਾਂ ਬੈਠਿਆ ਕਰਾਂਗੇ ਚਾਰ ਕੁਰਸੀਆਂ ਡਾਈਏ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਆਹੀਂ ਹੁੰਦਾ ਵੀ ਜੇ ਵਾਤਾਵਰਨ ਆਪਣੀ ਸਹੀ ਹੋਵੇਗੀ ਆਪਣੇ ਚਲੋ ਠੀਕ ਆ ਜੀ ਫਿਰ ਹੈਂ ਆਪਾਂ ਮਿਲਦੇ ਹਾਂ ਕਰਦੇ ਹਾਂ ਇਹ ਹਾਂਜੀ ਹਾਂਜੀ ਚਲੋ ਠੀਕ ਆ ਫਿਰ ਆਪਾਂ ਬਹਿੰਦੇ ਹਾਂ ਫਿਰ ਸਲਾਹ ਕਰਦੇ ਹਾਂ ਠੀਕ ਹੈ ਜੀ ਠੀਕ ਹੈ